ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਜੇਕਰ ਗੱਲ ਕਰਾਂ ਕਿ ਸਾਨੂੰ ਐੱਲ ਪੀ ਜੀ ਸਿਲੰਡਰ ਖਾਣਾ ਬਣਾਉਣ ਵਾਸਤੇ ਵਰਤਣਾ ਚਾਹੀਦਾ ਹੈ ਤਾਂ ਕਿ ਇਸ ਦੀ ਕਈ ਸਾਵਧਾਨੀਆਂ ਹੈ ਉਹ ਸਾਵਧਾਨੀਆਂ ਤੁਹਾਨੂੰ ਮੈਂ ਦੱਸਦਾ ਹਾਂ ਕਿ ਜਿਵੇਂ ਐੱਲ ਪੀ ਜੀ ਸਿਲੰਡਰ ਸਾਡੇ ਘਰ ਆਉਂਦਾ ਹੈ ਅਤੇ ਅਸੀਂ ਉਸ ਨਾਲ ਖਾਣਾ ਬਣਾਉਂਦੇ ਹਾਂ ਸਭ ਤੋਂ ਪਹਿਲੇ ਸਾਨੂੰ ਉਸ ਦਾ ਕਨੈਕਸ਼ਨ ਚੈੱਕ ਕਰਨਾ ਚਾਹੀਦਾ ਹੈ ਕਿ ਕਨੈਕਸ਼ਨ ਟਾਈਟ ਲੱਗਾ ਹੈ ਕਿ ਨਹੀਂ ਜੇਕਰ ਕਨੈਕਸ਼ਨ ਟਾਈਟ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਉਹਨੂੰ ਕੱਸ ਲੈਣਾ ਚਾਹੀਦਾ ਹੈ ਫੇਰ ਸਾਨੂੰ ਦੇਖਣਾ ਚਾਹੀਦਾ ਹੈ ਕਿ ਪੈਪ ਕਿਤੋਂ ਲੀਕ ਤਾਂ ਨਹੀਂ ਹੋ ਰਹੀ ਜਾਂ ਸਿਲੰਡਰ ਦੇ ਵਿੱਚੋਂ ਗੈਸ ਤੇ ਲੀਕ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਉਸ ਦੀ ਜਾਂਚ ਕਰਕੇ ਉਸਨੂੰ ਠੀਕ ਕਰਨਾ ਚਾਹੀਦਾ ਹੈ ਜੇ ਨਹੀਂ ਆਪਣੇ ਕੋਲੋਂ ਨਹੀਂ ਹੋਵੇ ਤਾਂ ਕੰਪਨੀ ਦੇ ਕਸਟਮਰ ਕੇਅਰ 'ਤੇ ਫੋਨ ਕਰਕੇ ਉਨ੍ਹਾਂ ਨੂੰ ਬੁਲਾ ਕੇ ਚੈੱਕ ਕਰਵਾ ਲੈਣਾ ਚਾਹੀਦਾ ਹੈ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਗੈਸ ਨਾਲ ਖੇਡਣ ਨਾ ਗੈਸ ਨਾਲ ਅਤੇ ਬੱਚਿਆਂ ਨੂੰ ਗੈਸ ਲਾਗੇ ਨਹੀਂ ਜਾਣਾ ਚਾਹੀਦਾ ਕਿਉਂਕਿ ਗੈਸ ਦੀ ਜਿਹੜੀ ਹਵਾ ਹੁੰਦੀ ਹੈ ਉਹ ਬਹੁਤ ਖਰਾਬ ਹੁੰਦੀ ਹੈ ਅਤੇ ਬੱਚਿਆਂ ਦੀ ਸਿਹਤ 'ਤੇ ਅਸਰ ਪਾ ਸਕਦੀ ਹੈ ਇਸ ਕਰਕੇ ਸਾਨੂੰ ਬੱਚਿਆਂ ਨੂੰ ਗੈਸ ਤੋਂ ਦੂਰ ਰੱਖਣਾ ਚਾਹੀਦਾ ਹੈ ਫਿਰ ਸਾ ਸਾਨੂੰ ਹਮੇਸ਼ਾ ਗੈਸ ਬਹੁਤ ਧਿਆਨ ਨਾਲ ਵਰਤਣੀ ਚਾਹੀਦੀ ਹੈ ਅਤੇ ਉਸ ਦੀ ਮਹੀਨੇ ਮਹੀਨੇ ਬਾਅਦ ਸਫ਼ਾਈ ਵੀ ਕਰਦੇ ਰਹਿਣਾ ਚਾਹੀਦਾ ਹੈ